ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਹਰੇਕ ਬੰਦੇ ਵਿੱਚ ਅਲੱਗ ਅਲੱਗ ਕਲਾਵਾਂ ਹੁੰਦੀਆਂ ਹਨ ਜਿਵੇਂ ਕਿ ਗਾਉਣ ਦੀ ਕਲਾ ਲਿਖਣ ਦੀ ਕਲਾ ਚਿੱਤਰ ਬਣਾਉਣ ਦੀ ਕਲਾ ਅਤੇ ਇਵੇਂ ਹੀ ਹੋਰ ਕਲਾਵਾਂ ਮੇਰੇ ਵਿੱਚ ਲਿਖਣ ਦੀ ਕਲਾ ਹੈ ਮੈਂ ਕਾਫੀ ਵਧੀਆ ਪੋਈਟਰੀ ਲਿਖ ਸਕਦਾ ਹਾਂ ਇਸ ਕਲਾ ਨੇ ਮੈਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਬਹੁਤ ਮਿਹਨਤ ਕੀਤੀ ਹੈ ਜੇਕਰ ਬੰਦਾ ਆਪਣੀ ਕਲਾ ਵਿੱਚ ਮਾਹਿਰ ਹੋਵੇ ਤਾਂ ਓਹ ਜ਼ਿੰਦਗੀ ਵਿੱਚ ਉਚਾਈਆਂ ਨੂੰ ਛੂਹ ਸਕਦਾ ਹੈ ਅਤੇ ਆਪਣੇ ਪਰਿਵਾਰ ਆਪਣੇ ਦੇਸ਼ ਆਪਣੇ ਸ ਲੋਕਾਂ ਲਈ ਆਪਣੇ ਸੱਭਿਆਚਾਰ ਲਈ ਬਹੁਤ ਹੀ ਵਧੀਆ ਕੰਮ ਕਰ ਸਕਦਾ ਹੈ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦਾ ਹੈ ਆਪਣੇ ਪਿੰਡ ਦਾ ਆਪਣੇ ਸਾਥੀਆਂ ਦਾ ਨਾਮ ਰੌਸ਼ਨ ਕਰ ਸਕਦਾ ਹੈ ਕਲਾ ਕਲਾਵਾਨ ਬੰਦਾ ਕਿਤੇ ਵੀ ਮਾਤ ਨਹੀਂ ਖਾਂਦਾ ਜੇਕਰ ਕਿਸੇ ਬੰਦੇ ਨੂੰ ਕਲਾ ਆਉਂਦੀ ਹੋਵੇ ਤਾਂ ਓਹ ਆਪਣੀ ਕਲਾ ਦੇ ਜ਼ਰੀਏ ਹਰ ਇੱਕ ਖਿੱਤੇ ਵਿੱਚ ਕੰਮ ਕਰ ਸਕਦਾ ਹੈ ਕਲਾਕਾਰ ਬੰਦਾ ਆਪਣੇ ਕਲਾ ਦੇ ਜ਼ਰੀਏ ਪੈਸੇ ਕਮਾ ਸਕਦਾ ਹੈ ਸਮਾਜ ਵਿੱਚ ਇੱਜ਼ਤ ਕਮਾ ਸਕਦਾ ਹੈ ਧੰਨਵਾਦ